ਸੱਤ ਜਨਵਰੀ ਉੱਨੀ ਸੌ ਸਤਾਨਵੇਂ ਇੱਕੀ ਮਾਰਚ ਉੱਨੀ ਸੌ ਤਿਹੱਤਰ ਪੰਜ ਅਗਸਤ ਉੱਨੀ ਸੌ ਸ ਅਠਾਨਵੇਂ ਦਸ ਅਕਤੂਬਰ ਉੱਨੀ ਸੌ ਪਚਾਨਵੇਂ ਨੌ ਅਗਸਤ ਉੱਨੀ ਸੌ ਸੱਤਰ